ਪੰਜਾਬ ਵਿੱਚ ਵਿਕਲਪਿਕ ਦਾ ਵਿਵਾਦ ਨਿਪਟਾਰਾ ਵਧੀਆ ਜਿਵੇਂ ਕਿ ਵਿਚੋਲਗੀ ਆ ਅਰਥ ਅਤੇ ਸੰਘਾਈ ਵਿਵਾਦਾਂ ਨੂੰ ਹੱਲ ਕਰਨ ਦੀ ਪ੍ਰਕਿਰਿਆ ਫਿਰ ਕਿਆ ਸਹਿਮਤੀ ਦੋਨਾਂ ਪੱਖਾਂ ਨੂੰ ਵਿਚੋਲਗੀ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਦੇ ਸਹਿਮਤ ਹੋਣਾ ਪੈਂਦਾ ਹੈ ਵਿਚੋਲਗੀ ਦੀ ਚੋਣ ਦੋਨਾਂ ਪੱਖਾਂ ਤੋਂ ਇੱਕ ਨਿਰਪੱਖ ਵਿਚੋਲਕ ਦੀ ਚੋਣ ਕਰਨੀ ਪੈਂਦੀ ਹੈ ਜੋ ਵਿਵਾਦ ਨੂੰ ਸੁਲਝਾਉਣ ਵਿੱਚ ਮਦਦ ਕਰਦਾ ਹੈ ਪ੍ਰਬੰਧਕ ਬੈਠਕ ਪਹਿਲੀ ਬੈਠਕ ਵਿੱਚ ਵਿਚੋਲਿਕ ਪੱਖਾ ਪ੍ਰਕਿਰਿਆ ਨੂੰ ਸਮਝਾਉਂਦਾ ਹੈ ਮੂਲ ਸੂ ਮੂਲ ਸੂਚਨਾਵਾਂ ਲੈਂਦਾ ਹੈ ਆਤਮਾ ਵਿਚ ਔਲਕ ਦੋਨਾਂ ਪੱਖਾਂ ਨਾਲ ਬਿਬਾਨਾਂ ਬੈਠਕਾਂ ਨਾਲ ਗੱਲਬਾਤ ਕਰਦਾ ਹੈ ਅਤੇ ਸਮਝੌਤੇ ਦੀ ਕੋਸ਼ਿਸ਼ ਕਰਾਉਂਦਾ ਹੈ ਕਲਾਮਾਤ ਗੋਪਨੀਆ ਅਤੇ ਅੰਦਰ ਪੱਖੀ ਹੁੰਦੀ ਹੈ ਸਮਝੌਤਾ ਜੇਕਰ ਦੋਨਾਂ ਪੱਖਾਂ ਦੀ ਮਦਦ ਨਾਲ ਸਮਝੌਤੇ 'ਤੇ ਪਹੁੰਚ ਜਾਂਦੇ ਤਾਂ ਇਸ ਨੂੰ ਲਿਖਤੀ ਰੂਪ ਤਿਆਰ ਕਰਕੇ ਦੋਨਾਂ ਪੱਖਾਂ ਦਾਆਰਾ ਹਸ਼ਤਾਕਸ਼ਰ ਕਰਵਾਇਆ ਜਾਂਦਾ ਹੈ ਕਾਨੂੰਨੀ ਮਾਨਤਾ ਸਫਲ ਵਿਚੋਲਗੀ ਤੋਂ ਬਾਅਦ ਤਿਆਰ ਹੋਏ ਸਮਝੌਤੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਹ ਕਾਨੂੰਨੀ ਤੌਰ 'ਤੇ ਅਧਿਕਾਰੀ ਬਣ ਜਾ ਸਕਦਾ ਹੈ ਅਤੇ